ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਐਨ ਪੀ ਐਸ ਦਫਤਰ ਤੋਂ ਗੱਲ ਕਰ ਰਹੇ ਹੋ ਮੈਂ ਬਰਿੰਦਰ ਸਿੰਘ ਸਨ ਆਫ ਨਾਨਕ ਸਿੰਘ ਗੱਲ ਕਰ ਰਿਹਾ ਮੈਂ ਨਾ ਕਪੂਰਥਲਾ ਵਿੱਚ ਜਿਹੜਾ ਮੇਰਾ ਪੁਰਾਣਾ ਘਰ ਸੀ ਮੈਂ ਸੇਲ ਕਰ ਦਿੱਤਾ ਅਤੇ ਨਵਾਂ ਘਰ ਮੈਂ ਲੈ ਲਿਆ ਸ਼ਿਫਟ ਕਰ ਦਿੱਤਾ ਉਧਰਲੀ ਸਾਈਡ ਅਤੇ ਮੇਰਾ ਜਿਹੜਾ ਡਰੈਸ ਸੀਗਾ ਉਹ ਮੇਰਾ ਖਾਤਾ ਨੰਬਰ ਸਾਰਾ ਚੇਂਜ ਕੀਤਾ ਜਾਵੇ ਤਾਂ ਜੋ ਮੈਨੂੰ ਕੋਈ ਨਾ ਪੁਰਾਣੇ ਜਿਹੜਾ ਮੇਰਾ ਡਰੈਸ ਸੀਗਾ ਉਹ 'ਤੇ ਕੋਈ ਚਿੱਠੀ ਵਗੈਰਾ ਉੱਧਰ ਨਾ ਜਾਈ ਜਾਵੇ ਅਤੇ ਨਵੀਂ ਸਾਈਡ ਮੇਰੀ ਸਾਰੀ ਜਿਹੜੀ ਮੈਨੂੰ ਸੁਵਿਧਾ ਮਿਲ ਸਕੇ ਅਤੇ ਮੇਰਾ ਹੁਣ ਨਵੇਂ ਮਕਾਨ ਦਾ ਐਡਰੈਸ ਸਬਜ਼ੀ ਮੰਡੀ ਨੇੜੇ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਕਰ ਦਿੱਤਾ ਜਾਵੇ ਅਤੇ ਆਪ ਜੀ ਦਾ ਮੈਂ ਧੰਨਵਾਦੀ ਹੋਵਾਂਗਾ ਠੀਕ ਹੈ ਜੀ ਧੰਨਵਾਦ ਜੀ